ਮੇਰੇ ਮਨਪਸੰਦ ਪੰਜਾਬੀ ਸ਼ਬਦ ਹਨ ਕਿਉਂਕਿ ਸ਼ਬਦ ਹੀ ਇੱਕ ਅਜਿਹੇ ਨੇ ਜਿਹਨਾਂ ਨਾਲ ਸਾਡੀ ਬੋਲੀ ਸਾਡੇ ਰਹਿਣ ਸਹਿਣ ਪਹਿਰਾਵੇ ਆਦਿ ਦਾ ਪਤਾ ਲੱਗਦਾ ਹੈ ਕਿਉਂਕਿ ਸ਼ਬਦਾਂ ਨਾਲ ਹੀ ਅੱਜ ਕੱਲ੍ਹ ਸਾਡੇ ਚਰਿੱਤਰ ਦਾ ਪਤਾ ਲੱਗਦਾ ਸਾਡੇ ਰਹਿਣ ਸਹਿਣ ਦਾ ਪਤਾ ਲੱਗਦਾ ਹੈ ਸ਼ਬਦ ਸ਼ਬਦ ਇੱਕ ਉਹ ਨਹੀਂ ਜਿਹਨਾਂ ਨਾਲ ਅਸੀਂ ਅਗਲੇ ਬੰਦੇ ਨੂੰ ਬੁਲਾ ਸਕਦੇ ਹਾਂ ਅਗਲੇ ਬੰਦੇ ਨੂੰ ਅਗਲੇ ਬੰਦੇ ਅੱਗੇ ਆਪਣੇ ਆਪ ਨੂੰ ਪੇਸ਼ ਕਰ ਸਕਦੇ ਹਾਂ ਉਦਾਹਰਨ ਦੇ ਤੌਰ 'ਤੇ ਜਿਵੇਂ ਕਿ ਅਸੀਂ ਕਿਸੇ ਨੂੰ ਬੁਲਾਉਣਾ ਹੋਵੇ ਤਾਂ ਅਸੀਂ ਅਗਲੇ ਬੰਦੇ ਨੂੰ ਤੁਸੀਂ ਕਹਿ ਕੇ ਬੁਲਾਉਂਦੇ ਹਾਂ ਕਿਉਂਕਿ ਇਹਦੇ ਵਿੱਚ ਜਿਹੜਾ ਸ਼ਬਦ ਤੁਸੀਂ ਆ ਉਹ ਰਿਸਪੈਕਟ ਨਾਲ ਆ ਜਾਂਦਾ ਕਿ ਅਗਲੇ ਬੰਦੇ ਦੀ ਆਪਾਂ ਇੱਜ਼ਤ ਕਰਦੇ ਹਾਂ ਠੀਕ ਹੈ ਕਿਉਂਕਿ ਸ਼ਬਦਾਂ ਨਾਲ ਹੀ ਦੁਹਰਾਇਆ ਜਾਂਦਾ ਹੈ ਸ਼ਬਦ ਹੀ ਹੁੰਦੇ ਨੇ ਜਿਹੜੇ ਕਿ ਸਾਡੀ ਮੇਨ ਜ਼ਿੰਦਗੀ ਦੇ ਵਿੱਚ ਮਹੱਤਵਪੂਰਨ ਨੇ ਆਪਾਂ ਕਿਸੇ ਨਾਲ ਗੱਲਬਾਤ ਕਰਦੇ ਹਾਂ ਉਦਾਹਰਨ ਦੇ ਵਜੋਂ ਜਦੋਂ ਆਪਾਂ ਕਿਸੇ ਨੂੰ ਬੁਲਾਉਂਦੇ ਹਾਂ ਤਾਂ ਆਪਾਂ ਪਹਿਲਾਂ ਸ਼ਬਦ ਇਹ ਕਹਿੰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਮੈਮ ਜਾਂ ਆਪਾਂ ਕਿਸੇ ਵੀ ਆਪਣੇ ਰਿਲੇਟਿਵਸ ਨੂੰ ਬੁਲਾਉਂਦੇ ਹਾਂ ਕਿਸੇ ਰਿਸ਼ਤੇਦਾਰ ਨਾਲ ਬੋਲਦੇ ਹਾਂ ਤਾਂ ਆਪਾਂ ਪਹਿਲਾਂ ਹੀ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਜੀ ਕਹਿ ਕੇ ਬੁਲਾਉਂਦੇ ਹਾਂ ਕਿਉਂਕਿ ਇਹ ਵੀ ਇੱਕ ਤਰ੍ਹਾਂ ਨਾਲ ਸ਼ਬਦ ਹੀ ਹਨ ਇਹਨਾਂ ਸ਼ਬਦਾਂ ਦੀ ਬਹੁਤ ਮਹੱਤਤਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਕਿਉਂਕਿ ਇਹਨਾਂ ਸ਼ਬਦਾਂ ਨਾਲ ਹੀ ਅਸੀਂ ਅਗਲੇ ਨੂੰ ਇਹਨਾਂ ਸ਼ਬਦਾਂ ਨਾਲ ਹੀ ਅਸੀਂ ਆਪਣੇ ਆਪ ਨੂੰ ਅਗਲੇ ਅੱਗੇ ਰੀਪ੍ਰਜੈਂਟ ਕਰ ਸਕਦੇ ਹਾਂ ਜਿੱਦਾਂ ਕਿ ਅਸੀਂ ਸਾਡੇ ਇਹਨਾਂ ਸ਼ਬਦਾਂ ਨਾਲ ਹੀ ਅ ਸਾਡਾ ਕਰੈਕਟਰ ਸਿੱਧ ਹੁੰਦਾ ਹੈ ਸਾਡਾ ਚਰਿੱਤਰ ਪਤਾ ਲੱਗਦਾ ਸਾਡਾ ਰਹਿਣ ਸਹਿਣ ਸਾਡੀ ਬੋਲ ਬਾਣੀ ਕਿ ਅਸੀਂ ਦੁਨੀਆ ਦੇ ਵਿੱਚ ਕਿਵੇਂ ਵਿਚਰ ਸਕਦੇ ਹਾਂ ਸ਼ਬਦਾਂ ਨਾਲ ਹੀ ਵਿਚਰਨਾ ਪੈਂਦਾ ਹੈ ਕਿਉਂਕਿ ਸ਼ਬਦ ਹੀ ਇੱਕ ਅਜਿਹੇ ਨੇ ਜੋ ਕਿ ਆਪਾਂ ਨੂੰ ਚੰਗੇ ਸ਼ਬਦ ਵੀ ਬੁਲਾ ਸਕਦੇ ਨੇ ਅਤੇ ਆਪਾਂ ਤੋ ਮਾੜੇ ਸ਼ਬਦ ਵੀ ਬੁਲਾ ਸਕਦੇ ਨੇ ਸ਼ਬਦ ਉਹ ਆਪਣੇ ਆਪਣੇ ਖੁਦ 'ਤੇ ਡਿਪੈਂਡ ਹੁੰਦਾ ਕਿ ਅਸੀਂ ਕਿਸੇ ਨਾਲ ਕਿੱਦਾਂ ਗੱਲ ਕਰ ਸਕਦੇ ਹਾਂ ਕਿੱਦਾਂ ਨਹੀਂ ਗੱਲ ਕਰ ਸਕਦੇ ਕਿਉਂਕਿ ਜਦੋਂ ਆਪਾਂ ਕਿਸੇ ਨੂੰ ਬੁਲਾਉਂਦੇ ਹਾਂ ਤਾਂ ਸਾਡੀ ਬੋਲ ਬਾਣੀ ਹੀ ਮੇਨ ਮਕਸਦ ਹੁੰਦੀ ਹੈ ਕਿਉਂਕਿ ਜਦੋਂ ਮੇਨ ਮਕਸਦ ਤਾਂ ਹੁੰਦੀ ਹੈ ਕਿਉਂਕਿ ਇਹਨਾਂ ਵਿੱਚ ਸ਼ਬਦ ਹੀ ਹੁੰਦੇ ਨੇ ਜਿਹੜੇ ਕਿ ਆਪਾਂ ਅਗਲੇ ਨੂੰ ਬੁਲਾਉਣ ਲਈ ਸਿਧ ਸਾਬਿਤ ਹੁੰਦੇ ਹਾਂ ਜਦੋਂ ਆਪਾਂ ਕਿਸੇ ਨਾਲ ਗੱਲ ਕਰਦੇ ਹਾਂ ਤਾਂ ਉਹ ਸ਼ਬਦਾਂ ਦੇ ਦੁਆਰਾ ਹੀ ਗੱਲ ਕੀਤੀ ਜਾਂਦੀ ਹੈ ਸਾਨੂੰ ਪੰਜਾਬੀ ਦੇ ਮੂਲ ਬੁਲਾਰੇ ਹੋਣ 'ਤੇ ਮਾਣ ਹੈ ਅਸੀਂ ਇਸ ਲਈ ਮਾਣ ਮਹਿਸੂਸ ਕਰਦੇ ਹਾਂ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਜੰਮੇ ਪਲੇ ਹਾਂ ਪੰਜਾਬ ਦੇ ਵਿੱਚ ਰਹਿਣ ਕਰਕੇ ਸਾਡੀ ਮੇਨ ਭਾਸ਼ਾ ਪੰਜਾਬੀ ਹੈ ਅਤੇ ਪੰਜਾਬੀ ਦੇ ਵਿੱਚ ਬਹੁਤ ਸਾਰੇ ਇੱਦਾਂ ਦੇ ਸ਼ਬਦ ਨੇ ਜਿਹੜੇ ਕਿ ਅਸੀਂ ਅਗਲਿਆਂ ਲਈ ਇੱਜ਼ਤ ਮਾਣ ਲਈ ਵਰਤਦੇ ਹਾਂ ਜਿੱਦਾਂ ਕਿ ਅਸੀਂ ਕਿਸੇ ਨੂੰ ਬੁਲਾਉਂਦੇ ਹਾਂ ਤਾਂ ਅਸੀਂ ਤੂੰ ਕਹਿਣ ਦੀ ਬਜਾਇ ਅਗਲੇ ਨੂੰ ਤੁਸੀਂ ਅਸੀਂ ਹਾਂਜੀ ਆਪਣਾ ਤੁਹਾਡਾ ਇੱਦਾਂ ਦੇ ਸ਼ਬਦ ਹੁੰਦੇ ਨੇ ਜਿਹੜੇ ਕਿ ਅਸੀਂ ਅਗਲਿਆਂ ਨੂੰ ਬੋਲਦੇ ਹਾਂ ਅਤੇ ਉਹਨਾਂ ਦਾ ਉਹਨਾਂ ਦਾ ਇੱਜ਼ਤ ਮਾਣ ਕਰਦੇ ਹਾਂ ਇਸ ਇਹਨਾਂ ਸ਼ਬਦਾਂ ਤੋਂ ਹੀ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਕਿੱਥੋਂ ਤੱਕ ਆਪਣੇ ਚਰਿੱਤਰ ਨੂੰ ਪ੍ਰਜੈਂਟ ਕਰ ਸਕਦੇ ਹਾਂ ਕਿਸੇ ਦੇ ਅੱਗੇ ਕਿਉਂਕਿ ਇਹਨਾਂ ਸ਼ਬਦਾਂ ਦੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਮਹੱਤਤਾ ਕਿਉਂਕਿ ਸ਼ਬਦਾਂ ਦੇ ਦੁਆਰਾ ਹੀ ਸਾਡਾ ਅਗਲੇ ਸ਼ਬਦਾਂ ਦੇ ਦੁਆਰਾ ਹੀ ਸਾਡਾ ਸਾਹਮਣੇ ਵਾਲੇ ਬੰਦੇ ਅੱਗੇ ਕਰੈਕਟਰ ਦਾ ਪਤਾ ਲੱਗਦਾ ਸਾਡਾ ਰਹਿਣ ਸਹਿਣ ਸਾਡੀ ਬੋਲ ਬਾਣੀ ਕਿਉਂਕਿ ਇਸ ਤਰ੍ਹਾਂ ਨਾਲ ਅਸੀਂ ਦੁਨੀਆ 'ਚ ਵੀ ਵਿਚਰਦੇ ਹਾਂ ਦੁਨੀਆ 'ਚ ਵਿਚਰਨ ਤੋਂ ਪਹਿਲਾਂ ਅਸੀਂ ਪਰਿਵਾਰ ਵਿੱਚ ਵਿਚਰਦੇ ਹਾਂ ਪਰਿਵਾਰ ਵਿੱਚ ਸਾਡੇ ਵਿੱਚ ਕਿਹੋ ਜਿਹੀ ਸ਼ਬਦਾਵਲੀ ਬੋਲੀ ਜਾਂਦੀ ਹੈ ਇਹ ਸਭ ਕੁਛ ਸਿੱਧ ਹੁੰਦਾ ਕਿਉਂਕਿ ਇਹ ਜ਼ਰੂਰੀ ਹੈ ਕਿ ਜਿੱਦਾਂ ਦੀ ਲੈਂਗੁਏਜ ਜਿੱਦਾਂ ਦੀ ਭਾਸ਼ਾ ਸਾਡੇ ਪਰ ਪਰਿਵਾਰ ਵਿੱਚ ਰਹਿ ਕੇ ਬੋਲੀ ਜਾਂਦੀ ਹੈ ਉਦਾਂ ਦੇ ਸੰਸਕਾਰ ਉਦਾਂ ਦੀ ਲੈਂਗੁਏਜ ਹੀ ਅਸੀਂ ਸਿੱਖਦੇ ਹਾਂ ਅਤੇ ਉਦਾਂ ਦੀ ਲੈਂਗੁਏਜ ਹੀ ਅਸੀਂ ਦੁਨੀਆ ਦੇ ਵਿੱਚ ਵਿਚਰਨ ਸਮੇਂ ਬੋਲਦੇ ਹਾਂ ਕਿਉਂਕਿ ਦੁਨੀਆ ਦੇ ਵਿਚ ਜੇਕਰ ਅਸੀਂ ਵਿਚਰਦੇ ਹਾਂ ਤਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਅਸ ਅਸੀਂ ਕਿਸੇ ਨਾਲ ਕਿੱਦਾਂ ਗੱਲ ਕਰਨੀ ਹੈ ਇਹ ਸਾਰੇ ਮੇਨ ਮਕਸਦ ਨੇ ਜਿਹੜੇ ਉਹ ਸ਼ਬਦਾਂ ਦੇ ਦੁਆਰਾ ਹੀ ਦਿੱਤੇ ਗਏ ਨੇ ਅਤੇ ਇਸ ਲਈ ਅਸੀਂ ਇਹ ਮਹਿਸੂਸ ਤਾਂ ਕਰਦੇ ਹਾਂ ਕਿ ਅਸੀਂ ਪੰਜਾਬੀ ਹਾਂ ਅਤੇ ਸਾਨੂੰ ਪੰਜਾਬੀ ਬਹੁਤ ਵਧੀਆ ਤਰੀਕੇ ਨਾਲ ਆਉਂਦੀ ਹੈ ਅਤੇ ਅਸੀਂ ਦੁਨੀਆ ਦੇ ਵਿੱਚ ਜੇਕਰ ਵਿਚਰਦੇ ਹਾਂ ਤਾਂ ਸਾਡੀ ਬੋਲੀ ਵੀ ਪੰਜਾਬੀ ਹੈ